ਹੈਲੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਸ਼ਹੀਦੀ ਸਿੰਘ ਗੁਰਦੁਆਰੇ ਤੋਂ ਬੋਲਦੇ ਹੋ ਬਾਬਾ ਜੀ ਬਾਬਾ ਜੀ ਮੈਂ ਆਪਣੇ ਬੱਚੇ ਦੀ ਅਡਮਿਸ਼ਨ ਕਰਵਾਉਣੀ ਸੀਗੀ ਅਤੇ ਹਾਂਜੀ ਹਾਂਜੀ ਟਕਸਾਲ ਵਿੱਚ ਅਡਮਿਸ਼ਨ ਕਰਵਾਈ ਸੀ ਆਪਦੇ ਬੱਚੇ ਦੀ ਮੇਰੇ ਬੱਚੇ ਦੀ ਉਮਰ ਹੈਗੀ ਆ ਆਹੀ ਚੌਦ੍ਹਾਂ ਕੁ ਸਾਲ ਅਤੇ ਬਾਬਾ ਜੀ ਮੈਨੂੰ ਦੱਸ ਦਿੰਦੇ ਕਿ ਕੀ ਕੀ ਕਰਵਾਉਣ ਅਖਾ ਕਰਵਾਉਂਦੇ ਆ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਠੀਕ ਹੈ ਗਤਕਾ ਗੁਤਕਾ ਬਾਬਾ ਜੀ ਅੱਛਾ ਬਾਬਾ ਜੀ ਅਤੇ ਕਿੰਨੇ ਟਾਈਮ 'ਚ ਸਿਖਾ ਦਿੰਦੇ ਆ ਬਾਬਾ ਜੀ ਹਾਂਜੀ ਬਾਬਾ ਜੀ ਹਾਂਜੀ ਬਾ ਐਵਰੇਜ ਜੇ ਬਾਬਾ ਜੀ ਬਾਬਾ ਜੀ ਇੱਕ ਅਤੇ ਕੋਈ ਨਹੀਂ ਅਡਮਿਸ਼ਨ ਦੱਸ ਦਿਉ ਕਿੰਨੇ ਪੈਸਿਆਂ ਦੀ ਕਰਵਾਉਣੀ ਹੈ ਠੀਕ ਹੈ ਬਾਬਾ ਜੀ ਅਤੇ ਕਦੋਂ ਤੋਂ ਸਟਾਰਟ ਕਰਾਂਗੇ ਕਲਾਸਾਂ ਬਾਬਾ ਜੀ

ਠੀਕ ਹੈ ਬਾਬਾ ਜੀ ਅਤੇ ਮੇਰੀ ਗੱਲ ਸੁਣੋ ਬਾਬਾ ਜੀ ਅਤੇ ਬਾਬਾ ਜੀ ਪੜ੍ਹਾਈ ਵਗੈਰਾ ਸਾਰਾ ਕੁਛ ਸਿਖਾ ਕਰਵਾ ਦਿਉਂਗੇ ਨਾ ਅਤੇ ਖਿੱਚ ਕੇ ਰੱਖਣਾ ਬੱਚੇ ਨੂੰ ਠੀਕ ਆ ਬਾਬਾ ਜੀ ਹਾਂਜੀ ਬਾਬਾ ਜੀ

ਹਾਂਜੀ ਹਾਂਜੀ ਠੀਕ ਹੈ ਬਾਬਾ ਜੀ ਠੀ ਹਾਂਜੀ ਹਾਂਜੀ ਬਾਬਾ ਜੀ ਤਾਂ ਹੀ ਪਾ ਰਹੇ ਇੱਥੇ ਕਿ ਬੱਚਾ ਗਲਤ ਰਾਹ 'ਤੇ ਨਾ ਜਾਵੇ ਅੱਜ ਕੱਲ੍ਹ ਦੀ ਦੁਨੀਆ ਹਾਂਜੀ ਅੱਜ ਕੱਲ੍ਹ ਦੀ ਦੁਨੀਆ ਬਾਰੇ ਤੁਹਾਨੂੰ ਵੀ ਪਤਾ ਬਾਬਾ ਜੀ ਠੀਕ ਹੈ ਜੀ ਬੱਚੇ ਨੂੰ ਆਪਾਂ ਚੰਗੇ ਰਾਹ 'ਤੇ ਪਾਉਂਦੇ ਹਾਂ ਠੀਕ ਆ ਬਾਬਾ ਜੀ ਅਤੇ ਬਾਬਾ ਹਾਂਜੀ ਹਾਂਜੀ ਠੀਕ ਆ ਬਾਬਾ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਧੰਨਵਾਦ ਠੀਕ ਆ ਬਾਬਾ ਜੀ